ਹੈਲੋ ਤੁਸੀਂ ਹਰਮਨ ਦੇ ਟੀਚਰ ਬੋਲ ਰਹੇ ਹੋ ਤੁਸੀਂ ਜੀ ਮੈਂ ਹਰਮਨ ਦਾ ਡੈਡੀ ਬੋਲ ਰਿਹਾ ਹਾਂਜੀ ਉਹ ਹਰਮਨ ਦੇ ਬਾਰੇ ਪੁੱਛਣਾਂ ਸੀਗਾ ਉਹਦਾ ਕੱਲ੍ਹ ਪਰਸੋਂ ਟੈਸਟ ਹੋਇਆ ਸੀ ਨਾ ਜੀ ਕਿਵੇਂ ਗਿਆ ਨਹੀਂ ਜੀ ਦਿਖਾਇਆ ਨਹੀਂ ਨਹੀਂ ਮੈਂ ਮੈਂ ਤਾਂ ਕੀਤਾ ਨਹੀਂ ਜੀ ਤਾਂ ਹੀ ਤੁਹਾਨੂੰ ਫ਼ੋਨ ਕੀਤਾ ਸੀਗਾ ਜੀ ਇੰਨਾ ਨੀ ਪਤਾ ਜੀ ਤੁਸੀਂ ਤੇ ਉਸ ਤੋਂ ਪੁੱਛਿਓ ਫਿਰ ਓ ਆ ਘਰੇ ਆਏਗਾ ਉਸ ਤੋਂ ਪੁੱਛਾਂਗਾ ਜੀ ਮੈਂ

ਕਿਉਂਕਿ ਅਸੀਂ ਤਾਂ ਅਸੀਂ ਤਾਂ ਦੋ ਦੋ ਟਿਊਟਰ ਵੀ ਰਖਾਏ ਵੇ ਆ ਉਹਦੇ ਵਾਸਤੇ ਸਕੂਲ ਤਾਂ ਜਾਂਦਾ ਜੀ ਪਿ ਪਿੱਛੇ ਫਿਰ ਹੁਣ ਉਹਦਾ ਕੀ ਕਰੀਏ ਤੁਸੀਂ ਸਮਝਾ ਸ਼ਾਇਦ ਤੁਹਾਡੀ ਜ਼ਿਆਦਾ ਸੁਣੇ ਹਾਂਜੀ ਹਾਂਜੀ

ਹਾਂਜੀ ਬਾਕੀ ਤੁਸੀਂ ਉਸਨੂੰ ਅੱਗੇ ਬਿਠਾਇਆ ਕਰੋ ਅਤੇ ਦੋਸਤਾਂ 'ਚ ਥੋੜ੍ਹਾ ਘੱਟ ਰੱਖੋ ਉਹਨੂੰ ਕਿਸੀ ਵਧੀਆ ਸਟੂਡੈਂਟ ਕਿਸੀ ਵਧੀਆ ਸਟੂਡੈਂਟ ਨਾਲ ਬੈਠਾ ਦਿਓ ਨਾ ਤੁਸੀਂ ਟੀਚਰਾਂ ਨੂੰ ਕਹਿ ਦਿਓ ਫਿਰ ਉਹਨਾਂ ਨੂੰ ਓਹੀ ਕੋਈ ਨਾ ਜੇ ਆਇਆ ਘਰ ਮੈਂ ਉਹਨੂੰ ਸਮਝਾਵਾਂਗਾ ਹਾਂਜੀ ਹੋਰ ਬਾਕੀ ਹੋਰ ਤਾਂ ਨਹੀਂ ਕੋਈ ਹੈਗੀ ਜੀ ਸ਼ਰਾਰਤਾਂ ਵਗੈਰਾ ਕਰਦਾ ਠੀਕ ਹੈ ਜੀ ਚਲੋ ਠੀਕ ਹੈ ਜੀ ਚਲੋ ਥੈਂਕ ਯੂ ਜੀ ਕੋਈ ਨਾ ਸਮਝਾਵੀ ਠੀਕ ਹੈ ਥੈਂਕ ਯੂ ਜੀ